ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਪਰਮਜੀਤ ਕੌਰ ਬੋਲ ਰਹੀ ਹਾਂ ਮੈਂ ਤੁਹਾਡਾ ਤੁਸੀਂ ਮੈਨੂੰ ਕੱਲ੍ਹ ਰਾਤ ਉਬਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਘਰ ਪਹੁੰਚਾਉਣ ਦੇ ਲਈ ਧੰਨਵਾਦ ਕਰਨ ਲਈ ਫੋਨ ਕੀਤਾ ਹੈ ਅਸਲ ਦੇ ਵਿੱਚ ਮੈਂ ਕੱਲ੍ਹ ਕਿਸੇ ਪ੍ਰੋਗਰਾਮ 'ਤੇ ਗਈ ਹੋਈ ਸੀ ਅਤੇ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਤੁਹਾਡੀ ਮਾਤਾ ਦੀ ਸਿਹਤ ਠੀਕ ਨਹੀਂ ਹੈ ਤਾਂ ਇੱਕਦਮ ਮੈਂ ਬਹੁਤ ਜ਼ਿਆਦਾ ਘਬਰਾ ਗਈ ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਤਾਂ ਫਿਰ ਮੈਂ ਉਬਰ 'ਤੇ ਤੁਹਾਨੂੰ ਸਰਚ ਕਰਕੇ ਤੁਹਾਡੇ ਕੰਟੈਕਟ ਕੀਤਾ ਅਤੇ ਤੁਸੀਂ ਮੈਨੂੰ ਉੱਥੋਂ ਪਿੱਕਅਪ ਕੀਤਾ ਤਾਂ ਮੈਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਘਬਰਾ ਹੋ ਰੀ ਘਬਰਾ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਤੁਸੀਂ ਮੈਨੂੰ ਹੌਂਸਲਾ ਦਿੱਤਾ ਉੱਥੇ ਹੌਂਸਲਾ ਦਿੱਤਾ ਅਤੇ ਕਿਹਾ ਕਿ ਕੋਈ ਗੱਲ ਨਹੀਂ ਸ਼ਾਂਤ ਹੋ ਜਾਓ ਮੈਂ ਤੁਹਾਨੂੰ ਸਹੀ ਸਮੇਂ ਦੇ ਵਿੱਚ ਹੀ ਘਰ ਪੁਹੰਚਾ ਦੇਵਾਂਗਾ ਤਾਂ ਮੈਨੂੰ ਮਨ ਦੇ ਵਿੱਚ ਡਰ ਬਣਿਆ ਹੋਇਆ ਸੀਗਾ ਅਤੇ ਹੌਲੀ ਹੌਲੀ ਅਤੇ ਜਦੋਂ ਮੈਂ ਦੇਖਿਆ ਤਾਂ ਤੁਸੀਂ ਮੈਨੂੰ ਸਹੀ ਸਮੇਂ 'ਤੇ ਘਰ ਪੁਹੰਚਾ ਦਿੱਤਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਅ ਜੀ ਅਤੇ ਤੁਸੀਂ ਮੈਨੂੰ ਇੱਕ ਸਲੀਕੇ ਦੇ ਨਾਲ ਸੁਰੱਖਿਆ ਦੇ ਰੂਪ ਦੇ ਵਿੱਚ ਘਰ ਪਹੁੰਚਾਇਆ